ਹੈਲੋ ਹਾਂਜੀ ਮੈਂ ਨਾ ਆਪਣੇ ਉਹ ਪੋਤੇ ਪੋਤੀਆਂ ਦੀ ਐਡਮਿਸ਼ਨ ਕਰਵਾਣੀ ਐ ਜੀ ਬੱਚਿਆਂ ਦੀ ਆਪਣੇ ਸ਼ਹਿਰ ਵਿੱਚ ਸਭ ਤੋਂ ਵਧੀਆ ਸਕੂਲ ਕਿਹੜਾ ਹੈਗਾ ਹਾਂਜੀ ਹਾਂਜੀ ਨਿਊ ਐਡਮਿਸ਼ਨ ਕਰਵਾਨੀ ਏ ਬੱਚੇ ਛੋਟੇ ਨੇ ਨਹੀਂ ਨਹੀਂ ਨਹੀਂ ਐਨੇ ਛੋਟੇ ਵੀ ਬੱਚੇ ਹੈਗੇ ਹਾਂਜੀ ਹਾਂ ਨਹੀਂ ਹੋਰ ਵੀ ਕੋਈ ਸਕੂਲ ਹੋਣਗੇ ਤੁਸੀਂ ਹੋਰ ਵੀ ਇੱਕ ਦੋ ਸਕੂਲ ਦੱਸੋ ਨਹੀਂ ਜਿਵੇਂ ਕੀ ਆਤਮ ਮਤਲਬ ਸਕੂਲ ਦੇ ਸੁਣਿਆ ਵੀ ਮੈਡਮ ਬੜੇ ਅੱਛੇ ਨੇ ਪ੍ਰਿੰਸੀਪਲ ਮੈਮ ਵੀ ਬਹੁਤ ਅੱਛੇ ਐ ਬੱਚਿਆਂ ਦੇ ਬਾਰੇ ਬਹੁਤ ਮਤਲਬ ਅੱਛਿਆ ਜੀ ਉਹ ਤਾਂ ਬੱਚਿਆਂ ਦੀ ਵੈਨਸ ਵਗੈਰਾ ਤਾਂਂ ਲੱਗੀਆਂ ਈ ਹੋਣਗੀਆਂ ਹਾਂਜੀ ਹਾਂਜੀ ਮੇਨ ਪ੍ਰਿੰਸੀਪਲ ਬੜੇ ਅੱਛੇ ਨੇ ਨਾ ਬਰ ਬੱਚਿਆਂ ਬਾਰੇ ਬਹੁਤ ਸੋਚਦੇ ਨੇ ਹਾਂਜੀ ਹਾਂਜੀ ਬੇਸ ਅੱਛਾ ਬਣਿਆ ਬੱਚੇ ਦਾ

ਹਾਂਜੀ ਹਾਂਜੀ ਨਹੀਂ ਫੀਸ ਦੀ ਗੱਲ ਨੀ ਹੈਗੀ ਬਸ ਬੱਚਿਆਂ ਦੀ ਥੋੜੀ ਜੀ ਇਹ ਅੱਛੀ ਮਤਲਬ ਕੇਅਰ ਹੁੰਦੀ ਹੋਵੇ ਉੱਥੇ ਬੱਚਿਆਂ ਨਾਲ ਸਟਡੀ ਅੱਛ ਅੱਛੀ ਹੋ ਰਹੀ ਐ ਅੱਛਿਆ ਸਟਡੀ ਅੱਛੀ ਹੋਵੇ ਠੀਕ ਐ

ਹਾਂਜੀ ਹਾਂਜੀ ਜੀ ਨਹੀਂ ਹਾਂ ਹਾਂਜੀ ਹਾਂਜੀ ਜੀ ਹਾਂ ਕੁਛ ਨੀ ਕਹਿੰਦੇ ਦੇਖਦੇ ਆਂ ਆਪਾਂ ਆਤਮਬਲ ਸਕੂਲ ਵਿੱਚ ਜਾ ਕੇ ਪਤਾ ਕਰੀਏ ਠੀਕ ਐ ਜੀ ਚਲੋ ਠੀਕ ਐ ਜੀ